ਹਾਂਜੀ ਅਸੀਂ ਤੋਤਾ ਬੋਲਦਾ ਹੋਇਆ ਵੇਖਿਆ ਹੈ ਸਾਡੇ ਘਰ ਇੱਕ ਤੋਤਾ ਸੀ ਜੋ ਸਾਡੇ ਸਾਰੇ ਪਰਿਵਾਰ ਨੂੰ ਬਹੁਤ ਪਿਆਰ ਕਰਦਾ ਸੀ ਅਤੇ ਸਾਡੇ ਪਿੱਛੋਂ ਹਰ ਇੱਕ ਬੋਲੀ ਬੋਲਦਾ ਸੀ ਜੋ ਮੈਂਬਰ ਸਾਡੇ ਘਰ ਦੇ ਵਿੱਚ ਬੋਲਦੇ ਸੀ ਤੋਤਾ ਪਿੱਛੇ ਪਿੱਛੇ ਉਹ ਹੀ ਬੋਲਦਾ ਸੀ ਸਵੇਰੇ ਉੱਠ ਕੇ ਉਹ ਰਾਮ ਰਾਮ ਕਰਦਾ ਸੀ ਸਾਨੂੰ ਉਹ ਬਹੁਤ ਹੀ ਜ਼ਿਆਦਾ ਸੋਹਣਾ ਲੱਗਦਾ ਸੀ ਅਤੇ ਉਹਦਾ ਬੋਲਣਾ ਸਾਨੂੰ ਬਹੁਤ ਹੀ ਚੰਗਾ ਅਤੇ ਪਿਆਰਾ ਲੱਗਦਾ ਸੀ ਉਹ ਸਾਡੇ ਨਾਲ ਬਹੁਤ ਹੀ ਜ਼ਿਆਦਾ ਪਿਆਰਾਂ ਅਤੇ ਅਨੁਭਵ ਉਸ ਦਾ ਬਹੁਤ ਹੀ ਚੰਗਾ ਸੀ ਸਾਡੇ ਮਨ ਦੀਆਂ ਗੱਲਾਂ ਵੀ ਉਹ ਕਰਦਾ ਸੀ ਤੋਤਾ ਹਰੀ ਮਿਰਚ ਵੀ ਖਾਂਦਾ ਸੀ ਅਤੇ ਉਹਦੀ ਬੋਲੀ ਵੀ ਬਹੁਤ ਸੋਹਣੀ ਸੀ ਇੱਕ ਬੋਲ ਮੈਨਾ ਵੀ ਬੋਲਦੀ ਹੈ ਮੈਨਾ ਦਾ ਅਨੁਭਵ ਵੀ ਬਹੁਤ ਚੰਗਾ ਹੁੰਦਾ ਹੈ ਉਹ ਬਹੁਤ ਹੀ ਸੋਹਣਾ ਅਤੇ ਮਨ ਭਾਉਂਦਾ ਪੰਛੀ ਹੈ ਤੋਤਾ ਵੀ ਬਹੁਤ ਸੋਹਣਾ ਅਤੇ ਮਨ ਭਾਉਂਦਾ ਪੰਛੀ ਹੈ ਸਾਨੂੰ ਤੋਤੇ ਦੀ ਭਾਸ਼ਾ ਸਿੱਖਣੀ ਚਾਹੀਦੀ ਹੈ ਬਹੁਤ ਜ਼ਿਆਦਾ ਤੋਤਾ ਅਤੇ ਮੈਨਾ ਬੋਲਦੇ ਹਨ